ਲੰਬੀ ਬਾਈਕਿੰਗ ਜਾਂ ਯਾਤਰਾ ਲਈ ਜਦੋਂ ਅਸੀਂ ਕਿਤੇ ਬਾਹਰ ਜਾਂਦੇ ਹਾਂ ਅਤੇ ਉਸ ਲਈ ਕੁਝ ਖਾਸ ਚੀਜ਼ਾਂ ਜੋ ਚਾਹੀਦੀਆਂ ਉਹਨਾਂ ਵਿੱਚ ਸਭ ਤੋਂ ਪਹਿਲਾਂ ਆਉਂਦਾ ਕਿ ਹੱਲ ਹੈਲਮੇਟ ਜੋ ਕਿ ਸਾਡੀ ਸਕਿਉਰਟੀ ਪਰਪਸ ਲਈ ਬਹੁਤ ਹੀ ਜ਼ਰੂਰੀ ਆ ਕਿਉਂਕਿ ਅਗਰ ਬਾਈ ਚਾਂਸ ਐਕਸੀ ਅਗਰ ਕੋਈ ਐਕਸੀਡੈਂਟ ਹੋ ਜਾਵੇ ਅਤੇ ਉਸ ਨਾਲ ਸਾਡੇ ਹੈਲਮਟ ਦੇ ਨਾਲ ਸਾਡੀ ਜੋ ਬ੍ਰੇਨ ਆ ਜਾਂ ਹੈਡ ਆ ਉਹਦੀ ਸਕਿਉਰਟੀ ਕੀਤੀ ਜਾ ਸਕਦੀ ਹੈ ਕਿ ਜ਼ਿਆਦਾ ਇਸ਼ੂ ਹੋਵੇ ਅਤੇ ਉਸ ਤੋਂ ਬਾਅਦ ਜਿਹੜਾ ਕਿਉਂਕਿ ਲੰਬੀ ਯਾਤਰਾ ਏ ਅਤੇ ਉਸ ਨਾਲ ਸਾਨੂੰ ਪਾਣੀ ਦੀ ਕਮੀ ਜਾਂ ਡੀਹਾਈਡਰੇਸ਼ਨ ਹੋ ਸਕਦੀ ਹੈ ਜਿਸ ਲਈ ਸਾਨੂੰ ਇੱਕ ਪਾਣੀ ਦੀ ਬੋਟਲ ਨਾਲ ਲਿਜਾਣੀ ਬਹੁਤ ਜ਼ਰੂਰੀ ਆ ਤਾਂ ਕਿ ਜਦੋਂ ਵੀ ਸਾਨੂੰ ਪਾਣੀ ਦੀ ਲੋੜ ਹੋਵੇ ਅਤੇ ਅਸੀਂ ਪੀ ਸਕੀਏ ਤੂੰ ਸ ਜੋ ਤੀਸਰੀ ਚੀਜ਼ ਏ ਉਹ ਆਪਾਂ ਕਹਿ ਸਕਦੇ ਹਾਂ ਕਿ ਟਾਇਰ ਲੀਵਰਜ਼ ਕਿ ਅਗਰ ਬਾਈ ਚਾਂਸ ਜਾਂ ਬਾਈਕਿੰਗ ਦੇ ਵਿੱਚ ਕੋਈ ਪ੍ਰੋਬਲਮ ਆ ਜਾਵੇ ਅਤੇ ਆਪਾਂ ਉਸਨੂੰ ਜੋ ਹੈ ਟਾਇਰ ਲੀਵਰਜ਼ ਦੇ ਨਾਲ ਸੈਟ ਕਰ ਸਕੀਏ ਅਤੇ ਉਸ ਤੋਂ ਬਾਅਦ ਸਪੇਅਰਸ ਟਿਊਬ ਅਗਰ ਮੰਨ ਲਓ ਕਿ ਬਾਈਕਿੰਗ ਦੇ ਜੋ ਟਾ ਟਾਇਰਸ ਨੇ ਉਹਨਾਂ ਵਿੱਚ ਕੁਛ ਮਤਲਬ ਕਿ ਖਰਾਬ ਹੋ ਜਾਏ ਜਾਂ ਮਤਲਬ ਕਿ ਫਟ ਜਾਏ ਜਾਂ ਖਰਾਬ ਹੋ ਜਾਏ ਉਸ ਨਾਲ ਕੀ ਆ ਸਪੇਅਰਸ ਟਿਊਬ ਆਪਾਂ ਚੇਂਜ ਕਰਕੇ ਅਤੇ ਉਹ ਫਿਰ ਤੋਂ ਬਾਈਕਿੰਗ ਜੋ ਚਲਾਉਣ ਦੇ ਯੋਗ ਹੋ ਜਾਵੇ ਤੀਸਰਾ ਏ ਕਿ ਪੰਪ ਕਿ ਅਗਰ ਬਾਈਕਿੰਗ ਦੇ ਵਿੱਚ ਜੋ ਟਿਊਬ ਆ ਉਹਦੇ ਵਿੱਚ ਹਵਾ ਘੱਟ ਜਾਵੇ ਜਾਂ ਕਿਸੇ ਪੱਥਰ ਦੇ ਕਰਕੇ ਜੋ ਹਵਾ ਨਿਕਲ ਜਾਵੇ ਅਤੇ ਆਪਾਂ ਜਿਹੜੇ ਪੰਪਸ ਨਾਲ ਕੀ ਆ ਦੁਬਾਰਾ ਤੋਂ ਹਵਾ ਭਰ ਸਕੀਏ ਅਤੇ ਤੀਸਰਾ ਮਤਲਬ ਕਿ ਇੱਕ ਹੋਰ ਚੀਜ਼ ਹੁੰਦੀ ਆ ਜਿਵੇਂ ਮਲਟੀ ਟਿਊਲਸ ਕਿ ਉਹ ਆਪਾਂ ਜਦੋਂ ਵੀ ਕੋਈ ਅਗਰ ਆਪਾਂ ਟਾਇਰ ਰੀ ਰੀਚੇਂਜ ਕਰਨਾ ਏ ਜਾਂ ਕੁਛ ਵੀ ਚੇਂਜ ਕਰਨਾ ਜਾਂ ਕੋਈ ਸਕਰੂ ਮਤਲਬ ਕਿ ਢਿੱਲਾ ਹੋ ਗਿਆ ਅਤੇ ਉਸਨੂੰ ਕੱਸਣ ਲਈ ਵੀ ਸਾਨੂੰ ਮਲਟੀ ਟਿਊਲਸ ਦੀ ਲੋੜ ਹੁੰਦੀ ਹੈ ਅਤੇ ਜਿਵੇਂ ਕਿ ਇਹਨਾਂ ਸਾਰੇ ਸਮਾਨਸ ਨੂੰ ਰੱਖਣ ਲਈ ਆਪਾਂ ਨੂੰ ਸੀਟ ਬੈਗ ਵੀ ਚਾਹੀਦਾ ਹੁੰਦਾ ਜਿਸ ਵਿੱਚ ਆਪਾਂ ਪ੍ਰੋਪਰ ਲੀ ਉਹ ਸਾਰਾ ਸਮਾਨ ਕੈਰੀ ਕਰ ਸਕੀਏ ਅਤੇ ਕੁਛ ਲਾਈਟਸ ਵੀ ਲਿਜਾਣੀ ਜ਼ਰੂਰੀ ਹੁੰਦੀ ਏ ਕਿਉਂਕਿ ਕਈ ਵਾਰੀ ਸ਼ਾਮ ਦਾ ਟਾਈਮ ਜਾਂ ਹਨੇਰਾ ਹੋ ਜਾਵੇ ਅਤੇ ਸਾਨੂੰ ਲਾਈਟ ਦੀ ਜ਼ਰੂਰਤ ਪੈਂਦੀ ਹੈ ਅਤੇ ਇਸ ਦੇ ਨਾਲ ਹੀ ਕੁਛ ਲੌਕ ਜਿਵੇਂ ਅਗਰ ਆ ਸਾਨੂੰ ਸਾ ਬਾਈਕਿੰਗ ਹੈ ਜੋ ਕਿਤੇ ਥੋੜ੍ਹੇ ਟਾਈਮ ਲਈ ਸਮੇਂ ਲਈ ਖੜ੍ਹੀ ਕਰਕੇ ਜਾਣਾ ਪਵੇ ਕਿ ਕਿਸੀ ਸ਼ੋਪ ਦੇ ਵਿੱਚ ਕੋਈ ਸਮਾਨ ਲੈਣ ਜਾਣਾ ਪਵੇ ਅਤੇ ਸਾਨੂੰ ਲੋੜ ਪੈਂਦੀ ਹੈ ਕਿ ਅਸੀਂ ਜੋ ਹੈ ਬਾਈਕਿੰਗ ਨੂੰ ਲੌਕ ਕਰ ਦਿੱਤਾ ਜਾਵੇ ਤਾਂ ਕਿ ਉਹ ਚੋਰੀ ਨਾ ਹੋਵੇ ਅਤੇ ਇਸ ਦੇ ਨਾਲ ਹੀ ਕੁਛ ਨਿਊਟ੍ਰੀਸ਼ਨਸ ਨਾਲ ਲਿਜਾਣਾ ਜ਼ਰੂਰੀ ਹੈ ਕਿ ਕਭੀ ਅਗਰ ਲੋੜ ਪਵੇ ਰੀਕਵਰੀ ਡਰਿੰਕ ਦੀ ਅਤੇ ਆਪਾਂ ਉਹ ਲੈ ਸਕੀਏ ਥੈਂਕ ਯੂ